ਮੈਂ ਅਤੇ ਮੇਰਾ ਫਰੈਂਡ ਫਿਲਮ ਚੈਰਿਟੀ ਲਈ ਇੱਕ ਫਿਲਮ ਨਾਈਟ ਲਈ ਆਪਾਂ ਆਪਣੇ ਫਰੈਂਡ ਲਈ ਦਿਖਾਉਣ ਲਈ ਪਿੰਡ ਵਿੱਚ ਸਕਰੀਨ ਤੇ ਬਾਗਵਨ ਫਿਲਮ ਦਿਖਾਈ ਉਸ ਵਿੱਚ ਬੱਚੇ ਬਜ਼ੁਰਗ ਹਾਜਰੀ ਲਵਾਈ ਉਹਨਾਂ ਨੇ ਉਸ ਫਿਲਮ ਵਿੱਚ ਜੋ ਦਰਸਾਇਆ ਗਿਆ ਹੈ ਕਿ ਬੱਚੇ ਆਪਣੇ ਮਾਂ ਪਿਓ ਨਾਲ ਕਿਸ ਤਰ੍ਹਾਂ ਦਾ ਵਰਤਾਵ ਕਰਦੇ ਨੇ ਹਾਲਾਂਕਿ ਬੱਚਿਆਂ ਨੂੰ ਇਸ ਤਰ੍ਹਾਂ ਦਾ ਵਰਤਾਵ ਨਹੀਂ ਕਰਨਾ ਚਾਹੀਦਾ ਥਰਡ ਪਰਸਨ ਜਿਨਾਂ ਨੇ ਉਸਨੂੰ ਸਲਮਾਨ ਖਾਨ ਦਾ ਰੋਲ ਵਿੱਚ ਆਉਂਦਾ ਜੋ ਕਿ ਉਹਨਾਂ ਨੇ ਇੱਕ ਉਹਨਾਂ ਨੂੰ ਪਾਲਿਆ ਹੁੰਦਾ ਉਸ ਨੂੰ ਉਹ ਬੰਦਾ ਬਾਹਰੋਂ ਆ ਕੇ ਉਨਾਂ ਦੀ ਦੇਖਭਾਲ ਕਰਦਾ ਹੈ ਉਹਨਾਂ ਨੂੰ ਸਾਂਦਾ ਬਾਕੀ ਫਾਦਰ ਦਾ ਵੀ ਰੋਲ ਅਮਿਤਾਬ ਬੱਚਨ ਸਾਹਿਬ ਜੀ ਹੋਰਾਂ ਨੇ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ ਉਹਨਾਂ ਦੇ ਬੱਚੇ ਸੈਲਫਿਸ਼ ਹੋਣ ਕਾਰਨ

ਕਿਤੇ ਵੀ ਉਹਨਾਂ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਨਾ ਕਰੀਏ ਸੀਨੀਅਰ ਦੀ ਰਿਸਪੈਕਟ ਕਰੀਏ ਹਮੇਸ਼ਾ ਇਕ ਦੂਜੇ ਨਾਲ ਰਲ ਮਿਲ ਕੇ ਰਹੀਏ ਫੈਮਲੀ ਨਾਲ ਰਲ ਮਿਲ ਕੇ ਰਹੀਏ ਏਕਤਾ ਚ ਬਲ ਹੁੰਦਾ ਹੈ ਆਪਣੇ ਮਾਂ ਪਿਓ ਬਹੁਤ ਹੀ ਵਧੀਆ ਰਿਸਪਾਂਸ ਮਿਲਿਆ ਲੋਕਾਂ ਦੁਆਰਾ ਫਰੈਂਡਸ ਦੁਆਰਾ ਅਤੇ ਮੈਂ ਤੇ ਮੇਰਾ ਫਰੈਂਡਸ ਇਹ ਸੁਣ ਕੇ ਕੀ ਸਾਡੀ ਫਿਲਮ ਜੋ ਲਗਾਈ ਸੀ ਲੋਕਾਂ ਨੂੰ ਕੁਝ ਸਿੱਖਣ ਨੂੰ ਮਿਲਿਆ ਬਹੁਤ ਸਾਨੂੰ ਖੁਸ਼ੀ ਹੋਈ